ਮੈਂ ਆਪਣੇ ਕੈਰੀਅਰ ਦੇ ਭਵਿੱਖ ਵਿੱਚ ਇਹ ਸੋਚਦਾ ਹਾਂ ਕਿ ਮੈਂ ਆਪਣੇ ਪਰਿਵਾਰ ਲਈ ਬੱਚਿਆਂ ਲਈ ਉਨ੍ਹਾਂ ਨੂੰ ਵਧੀਆ ਸਹੂਲਤ ਦੇ ਸਕਾਂ ਅਤੇ ਆਪਣੇ ਮਾਂ ਬਾਪ ਦਾ ਬੁਢਾਪੇ ਵਿੱਚ ਸਹਾਰਾ ਬਣ ਸਕਾਂ ਅਤੇ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਾਂ ਅਤੇ ਉਹਨਾਂ ਲਈ ਸਭ ਕੁਝ ਕਰ ਸਕਾਂ ਜੋ ਆਪਣੇ ਮਾਂ ਬਾਪ ਕਿਸੇ ਆਪਣੇ ਬੱਚੇ ਤੋਂ ਭਾਲ਼ ਸਕਦੇ ਹਨ